ਇਸ ਖੇਤਰ ਦੇ ਵਿੱਚ ਸਾਨੂੰ ਅਕਸਰ ਜਿਹੜੇ ਆ ਉਹ ਤੋਤਾ ਕਾਂ ਚਿੜੀਆਂ ਸਰਕਾਂ ਕਬੂਤਰ ਇਹੋ ਜਿਹੇ ਪੰਛੀ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਆ ਸਾਡੇ ਆਲੇ ਦੁਆਲੇ ਆਲੇ ਦੁਆਲੇ ਦੇ ਵਿੱਚ ਅਤੇ ਪਰ ਜਿਹੜੇ ਮੈਨੂੰ ਜਿਹੜਾ ਸਭ ਤੋਂ ਵਧੀਆ ਪੰਛੀ ਜਿਹੜਾ ਲੱਗਦਾ ਉਹ ਹੈ ਬਾਜ ਬਾਜ ਆਕਾਰ ਦੇ ਵਿੱਚ ਵੀ ਬਹੁਤ ਵੱਡਾ ਹੁੰਦਾ ਹੈ ਔਰ ਇਸ ਦੀ ਖਾਸੀਅਤ ਜਿਹੜੀ ਉਹ ਇਹ ਕਿ ਇਹ ਅਸਮਾਨ ਦੇ ਵਿੱਚ ਬਹੁਤ ਉਚਾਈ 'ਤੇ ਉੱਡ ਸਕਦਾ ਔਰ ਇੰਨੀ ਜ਼ਿਆਦਾ ਉਚਾਈ 'ਤੇ ਉੱਡਣ ਦੇ ਬਾਵਜੂਦ ਇਹ ਧਰਤੀ ਉੱਤੇ ਜਿਹੜਾ ਹੈ ਉਹ ਘੁੰਮਦੇ ਇੱਕ ਚੂਹੇ ਨੂੰ ਜਿਹੜਾ ਹੈ ਉਸਨੂੰ ਦੇਖ ਸਕਦਾ ਹੈ ਔਰ ਇਹ ਇੰਨੀ ਤੀਬਰਤਾ ਦੇ ਨਾਲ ਮਤਲਬ ਜਿਹੜਾ ਇੰਨੀ ਫੁਰਤੀ ਦੇ ਨਾਲ ਉਸਦੀ ਮਤਲਬ ਉਸਦਾ ਸ਼ਿਕਾਰ ਕਰਦਾ ਏ ਅੱਖ ਦੇ ਮਤਲਬ ਦੇ ਪਰੋਖੇ ਦੇ ਵਿੱਚ ਜਿਹੜਾ ਮਤਲਬ ਉਸਨੂੰ ਲੈ ਕੇ ਉੱਡ ਜਾਂਦਾ ਮਤਲਬ ਇੰਨੀ ਜ਼ਿਆਦਾ ਇਹਦੀ ਫੁਰ ਇਹ ਫੁਰਤੀਲਾ ਹੈ ਔਰ ਇਹਦੀ ਖਾਸੀਅਤ ਇਹ ਵੀ ਹੈ ਕਿ ਇਹ ਆਪਣਾ ਸ਼ਿਕਾਰ ਖੁਦ ਕਰਦਾ ਹੈ ਭਾਵ ਕਿ ਇਹ ਮਰਿਆ ਹੋਇਆ ਮਤਲਬ ਜੀਵਾਂ ਦਾ ਜਿਹੜਾ ਉਹਨਾਂ ਨੂੰ ਨਹੀਂ ਖਾਂਦਾ ਇਹ ਆਪਣਾ ਸ਼ਿਕਾਰ ਖੁਦ ਕਰਕੇ ਫਿਰ ਮਤਲਬ ਉਸਨੂੰ ਖਾਂਦਾ ਮਤਲਬ ਆਪਣਾ ਸ਼ਿਕਾਰ ਖੁਦ ਕਰਦਾ ਇਹ ਸੋ ਇਸ ਕਰਕੇ ਮੈਨੂੰ ਜਿਹੜਾ ਇਹ ਪੰਛੀ ਜਿਹੜਾ ਮਤਲਬ ਬਹੁਤ ਵਧੀਆ ਲੱਗਦਾ